ਯੋਗਾ ਸਿਰਫ ਇੱਕ ਵਿਆਮ ਹੀ ਨਹੀਂ ਬਲਕਿ ਇੱਕ ਇਹ ਅਧਿਆਤਮਿਕ ਅਤੇ ਵਿਗਿਆਨਿਕ ਪ੍ਰਗਤੀ ਹੈ ਜੋ ਮਨੁੱਖ ਦੇ ਵਿਕਾਸ ਸਰੀਰ ਮਨ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ ਇਹ ਸਰੀਰ ਦੀ ਲਚਕਤਾ ਨੂੰ ਵਧਾਉਂਦਾ ਹੈ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਸ ਸਰੀਰਕ ਸੰਤੁਲਨ ਨੂੰ ਬਿਹਤਰ ਬਣਾਉਂਦਾ ਹੈ ਨਿੱਤ ਯੋਗਾ ਕਰਨ ਨਾਲ ਤਾਕਤ ਸਹਿਨਸ਼ੀਲਤਾ ਅਤੇ ਊਰਜਾ ਪੱਧਰ ਵੱਧਦੇ ਹਨ ਜਿਸ ਨਾਲ ਦਿਨ ਭਰ ਚੁਸਤ ਮਹਿਸੂਸ ਹੁੰਦਾ ਹੈ ਇਹ ਤਣਾਅ ਸਟਰੈਸ ਅਤੇ ਡਿਪਰੈਸ਼ਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਯੋਗਾ ਕਰਨ ਨਾਲ ਮਸਤਕ ਵਿੱਚ ਖੁਸ਼ਹਾਲੀ ਵਾਲੇ ਹਾਰਮੋਨ ਨਿਕਲਦੇ ਹਨ ਜੋ ਮਨ ਨੂੰ ਸ਼ਾਂਤ ਔਰ ਖੁਸ਼ ਰੱਖਦੇ ਹਨ ਇਹ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਜਿਸ ਨਾਲ ਵਿਅਕਤੀ ਦੀ ਸਮਝਣ ਅਤੇ ਸਿੱਖਣ ਦੀ ਯੋਗਤਾ ਵਿੱਚ ਸੁਧਾਰ ਆਉਂਦਾ ਹੈ ਯੋਗਾ ਦਿਲ ਦੀ ਤੰਦਰੁਸਤੀ ਨੂੰ ਬਿਹਤਰ ਬਣਾਉਂਦਾ ਆ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਪਾਚਨ ਤੰਤਰ ਵੀ ਮਜ਼ਬੂਤ ਕਰਦਾ ਹੈ ਮਾਨਸਿਕ ਤੌਰ 'ਤੇ ਯੋਗਾ ਤੁਹਾਡੇ ਤਨਾਅ ਚਿੰਤਾ ਅਤੇ ਡਿਪਰੈਸ਼ਨ ਨੂੰ ਘਟਾਉਂਦਾ ਹੈ ਇਸ ਕਰਕੇ ਯੋਗਾ ਰੋਜ਼ ਕਰੋ